ਦੋਸਤੋ ਮੈਂ ਇੱਕ ਕਿਤਾਬ ਪੜ੍ਹੀ ਬਾਗ਼ ਬਗ਼ੀਚੀ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਇਹ ਕਿਤਾਬ ਬੜੀ ਰੋਚਕ ਨਹੀਂ ਪਰੰਤੂ ਜਿਵੇਂ ਜਿਵੇਂ ਮੈਂ ਉਸ ਕਿਤਾਬ ਨੂੰ ਬਰੀਕੀ ਨਾਲ਼ ਪੜ੍ਹਦਾ ਗਿਆ ਮੈਨੂੰ ਉਸ ਬਾਰੇ ਬਹੁਤ ਸਾਰੀ ਗੱਲਾਂ ਡੂੰਘਾਈ ਦੇ ਵਿੱਚ ਪਤਾ ਲੱਗੀਆਂ